ਹੈਲੋ ਹੈਲੋ ਹਾਂਜੀ ਨਮਸਤੇ ਹਾਂਜੀ ਗੁਰਦਾਸਪੁਰ ਪੂਜਾ ਹਾਂਜੀ ਹਾਂਜੀ ਹਾਂਜੀ ਇੱਥੇ ਹਾਂਜੀ ਇੱਥੋਂ ਦਾ ਮੈਮ ਲੋਹੜੀ ਦਾ ਤਿਉਹਾਰ ਬੜਾ ਫੇਮਸ ਹੈ ਹਾਂਜੀ

ਹਾਂਜੀ ਮੈਮ ਲੋਹੜੀ 'ਤੇ ਪਹਿਲਾਂ ਤਾਂ ਸੁਬਾਹ ਜਿਸ ਤਰ੍ਹਾਂ ਵੀ ਬੱਚੇ ਆ ਜਿੱਦਾਂ ਵੱਡੇ ਪਤੰਗਾਂ ਵਗੈਰਾ ਉਡਾਉਂਦੇ ਆ ਹੈ ਨਾ ਅਤੇ ਇਸ ਦਿਨ ਜਿੱਦਾਂ ਪੂਰੀ ਤਰ੍ਹਾਂ ਦੇ ਪਕਵਾਨ ਵਗੈਰਾ ਬਣਾਏ ਜਾਂਦੇ ਆ ਘਰ 'ਚ ਜਿੱਦਾਂ ਸਾਗ ਰਿੰਨ੍ਹਿਆ ਜਾਂਦਾ ਰੋਹ ਦੀ ਖੀਰ ਵਗੈਰਾ ਬਣਾਈ ਜਾਂਦੀ ਹੈ ਹਾਂਜੀ ਅਤੇ ਫਿਰ ਦ ਵਗੈਰਾ ਹੁੰਦਾ ਉਹਦੇ ਉਹਦੇ ਉਸ ਉਸ ਘਰ 'ਚ ਜ਼ਿਆਦਾ ਮਨਾਇਆ ਜਾਂਦਾ ਵਿਆਹ ਸ਼ਾਦੀ 'ਤੇ ਮਨਾਇਆ ਜਾਂਦਾ ਹਾਂਜੀ ਸ਼ਾਮ ਨੂੰ ਜਿੱਦਾਂ ਬੱਚੇ ਵਗੈਰਾ ਕਈ ਵੱਡੇ ਵੀ ਲੋਹੜੀ ਮੰਗਣ ਜਾਂਦੇ ਆ ਫਿਰ ਰਾਤ ਨੂੰ ਲੋਹੜੀ ਮਨਾਉਂਦੇ ਆ ਕਾਫੀ ਇੰਜੋਏਮੈਂਟ ਹੁੰਦੀ ਹੈ ਹਾਂਜੀ ਹਾਂਜੀ

ਹਾਂਜੀ ਹਾਂਜੀ ਨਹੀਂ ਨਹੀਂ ਬਹੁਤ ਬੱਚੇ ਕਾਫੀ ਇੰਜੋਏ ਕਰਦੇ ਆ ਆਪਣਾ ਜਿੱਦਾਂ ਪੰਜਾਬੀ ਸੌਂਗ 'ਚ ਭੰਗੜਾ ਵਗੈਰਾ ਗਿੱਧਾ ਵੀ ਕਾਫੀ ਫੇਮਸ ਹੋ ਜਾਂਦਾ ਲੋਹੜੀ 'ਤੇ ਔਰ ਮੈਮ ਹਾਂਜੀ ਬਸ ਇਹੀ ਮੈਮ ਜਿੱਦਾਂ ਕਈ ਪਾਰਟੀ ਵਿਆਹ ਸ਼ਾਦੀ 'ਤੇ ਜਿੱਦਾਂ ਇੰਜੋਏ ਕਰਦੇ ਇਸ ਤਰ੍ਹਾਂ ਵੀ ਖਾਣਾ ਵਗੈਰਾ ਵੀ ਇਨਵਾਈਟ ਕਰਦੇ ਆ ਆਪਣੇ ਜਿੱਦਾਂ ਫੈਮਲੀ ਮੈਂਬਰ ਹੋ ਗਏ ਜਾਂ ਰੈਲੇਟੀਵ ਵਗੈਰਾ ਸਭ ਨੂੰ ਇਨਵਾਈਟ ਕਰਦੇ ਆ ਖਾਣੇ 'ਤੇ ਹਾਂਜੀ ਰਾਤ ਨੂੰ ਫੇਰ ਲੋਹੜੀ ਬਾਲਦੇ ਹੈ ਹਾਂਜੀ ਠੀਕ ਜੀ ਓਕੇ